ਚਿੱਤਰਕਾਰੀ ਵਿੱਚ ਹਰ ਚੀਜ਼ ਬਣਾਈ ਜਾਂਦੀ ਹੈ ਬਣਦੀ ਵੀ ਹੈ ਅਤੇ ਦਿਖਦੀ ਵੀ ਹੈ ਅਤੇ ਸੋਹਣੀ ਵੀ ਲੱਗਦੀ ਹੈ ਲੇਕਿਨ ਸਮਾਂ ਅਤੇ ਉਸ ਦੀ ਨਿਖਾਰ ਜਿਹੜਾ ਹੈ ਸਮੇਂ ਨਾਲ ਆਉਂਦਾ ਜਿੰਨਾ ਵੱਧ ਅਸੀਂ ਉਸ ਨੂੰ ਉਤਾਰਦੇ ਹਾਂ ਉਸ ਨੂੰ ਬਣਾਉਂਦੇ ਰਹਿੰਦੇ ਹਾਂ ਉਸ ਦੇ ਨਾਲ ਆਪਣੀ ਜਿਹੜੀ ਕਲਾਕਾਰੀ ਆ ਹੋਰ ਉਭਰ ਕੇ ਆਉਂਦੀ ਹੈ ਹੁਣ ਦੇਖਿਆ ਜਾਵੇ ਤਾਂ ਜਿਹੜੀ ਮੇਰਾ ਚੁਣੌਤੀਪੂਰਨ ਪਹਿਲੂ ਸੀਗਾ ਉਹ ਇਹ ਸੀ ਕਿ ਜਿਹੜੇ ਮਨੁੱਖ ਦਾ ਮਨੁੱਖ ਦਾ ਮੂੰਹ ਹੈ ਕਿਸੇ ਮੁੰਡੇ ਦਾ ਸ਼ਕਲ ਹੈ ਸੂਰਤ ਹੈ ਕਿਸੇ ਅੱਖਾਂ ਨੇ ਨੱਕ ਬੁੱਲ ਹੈ ਇਹ ਜਿਹੜਾ ਮਨੁੱਖੀ ਚਿਤਰਣ ਆ ਉਹ ਨਹੀਂ ਹੁੰਦਾ ਮੇਰੇ ਤੋਂ ਪਰ ਮੈਂ ਉਹਨੂੰ ਫਿਰ ਵੀ ਆਪਣੇ ਤਰੀਕੇ ਨਾਲ ਆਪਣੀ ਅਭਿਆਸ ਨਾਲ ਉਹਨੂੰ ਪੂਰੇ ਤਰੀਕੇ ਨਾਲ ਉਤਾਰਨ ਦੀ ਕੋਸ਼ਿਸ਼ ਕਰਦਾ ਅਤੇ ਹੋਰ ਵੀ ਚੀਜ਼ਾਂ ਨੇ ਜਿਵੇਂ ਕਿ ਆਪਣਾ ਪਸ਼ੂਆਂ ਦੇ ਜਿਹੜੇ ਅ ਕੁਛ ਨੈਣ ਨਕਸ਼ ਨੇ ਨਾ ਇਹ ਚੀਜ਼ਾਂ ਕਾਫੀ ਔਖੀਆਂ ਨੇ ਬਣਾਉਣੀਆਂ ਜੇ ਆਪਾਂ ਬਿਲਡਿੰਗਾਂ ਦੀ ਗੱਲ ਕਰੀਏ ਬਿਲਡਿੰਗਾਂ ਆਰਕੀਟੈਕਚਰ ਨੂੰ ਆਪਾਂ ਇੱਕ ਅਤੇ ਪ ਪੇਜ਼ 'ਤੇ ਉਤਾਰਨਾ ਉਹ ਵੀ ਕਾਫੀ ਥੋੜ੍ਹਾ ਅ ਦਿੱਕਤ ਤਾਂ ਆਉਂਦੀ ਆ ਪਰ ਹਾਂ ਜਿੰਨੀ ਆਪਾਂ ਆਪਣੀ ਕੋਸ਼ਿਸ਼ ਕਰਦੇ ਰਹਾਂਗੇ ਅਭਿਆਸ ਕਰਦੇ ਰਹਾਂਗੇ ਉਵੇਂ ਉਵੇਂ ਆਪਣੇ ਜਿਹੜਾ ਨਿਖਾਰ ਹੈ ਜਿਹੜਾ ਚਿੱਤਰਕਾਰੀ ਦੇ ਵਿੱਚ ਉਹ ਹੌਲੀ ਹੌਲੀ ਆਉਂਦਾ ਰਹਿੰਦਾ ਅਤੇ ਇੱਦਾਂ ਵੀ ਜਿੰਨਾ ਜਿਹੜੀ ਚੀਜ਼ ਮੈਨੂੰ ਸੋਹਣੀ ਲੱਗਦੀ ਹੈ ਮੈਂ ਉਹਨੂੰ ਆਪਣੀ ਚਿੱਤਰਕਾਰੀ ਦੇ ਵਿੱਚ ਆਪਣੀ ਡਰਾਇੰਗ ਦੇ ਵਿੱਚ ਉਤਾਰ ਦਿੰਦਾ